ਹੁਣ ਅਸੀਂ ਕਹਿ ਸਕਦੇ ਹਾਂ ਜਿੱਦਾਂ ਕੋਈ ਵੀ ਅਸੀਂ ਘਰ ਦੇ ਵਿੱਚ ਮਹਿਮਾਨ ਆਇਆ ਅਸੀਂ ਉਹਨਾਂ ਵਾਸਤੇ ਕੋਈ ਖਾਣਾ ਬਣਾਉਣਾ ਦੁਪਹਿਰ ਦੀ ਰੋਟੀ ਨਾਲੇ ਰਾਤ ਦਾ ਬਣਾਉਣਾ ਤਾਂ ਕੋਈ ਵੀ ਅਸੀਂ ਇੱਦਾਂ ਜੇ ਪਕਵਾਨ ਬਣਾਉਂਦੇ ਹਾਂ ਕਿ ਜਿਹੜੇ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਜਾਂਦੇ ਆ ਫਿਰ ਉਹ ਆਪਣੇ ਵੱਲੋਂ ਪੁੱਛਦਾ ਕਿ ਤੁਸੀਂ ਇਹ ਚੀਜ਼ ਬਣਾਈ ਅਸੀਂ ਬਣਾਉਂਦੇ ਹਾਂ ਤਾਂ ਉਹਦੇ 'ਚ ਇੱਦਾਂ ਹੁੰਦਾ ਪਰ ਤੁਸੀਂ ਅੱਜ ਬਣਾਇਆ ਸਾਨੂੰ ਬਹੁਤ ਸਵਾਦ ਲੱਗਿਆ ਤਾਂ ਉਹਦੇ ਵਾਸਤੇ ਫਿਰ ਅਸੀਂ ਦੱਸਦੇ ਹਾਂ ਅਸੀਂ ਕੀ ਕੀਤਾ ਹੁਣ ਜਿੱਦਾਂ ਅਸੀਂ ਗੋਭੀ ਹੈ ਹੁਣ ਕਈ ਬਣਾਉਂਦੇ ਘੁਲੀ ਗੋਭੀ ਬਣਾ ਲੈਂਦੇ ਕਈ ਬਣਾਉਂਦੇ ਖੜ੍ਹੀ ਗੋਭੀ ਹੁਣ ਉਹ ਆ ਕੇ ਪੁੱਛਣਗੇ ਤੁਹਾਡੀ ਗੋਭੀ ਤਾਂ ਬੜੀ ਖੜ੍ਹੀ ਖੜ੍ਹੀ ਬਣੀ ਹੈ ਪਰ ਸਾਡੇ ਕੋਲੋਂ ਤਾਂ ਇਹ ਘੁੱਲ ਜਾਂਦੀ ਹੈ ਤਾਂ ਫਿਰ ਅਸੀਂ ਉਹਨਾਂ ਨੂੰ ਦੱਸੀਦਾ ਕਿ ਹਾਂ ਵੀ ਤੁਸੀਂ ਪਹਿਲੇ ਇਹਨੂੰ ਭਿਉਂ ਕੇ ਉਹਨੂੰ ਛਾਣਨੀ 'ਚ ਕਮ ਸੇ ਕਮ ਅੱਧਾ ਪੌਣਾ ਘੰਟਾ ਰੱਖੋ ਜਿਸ ਤੋਂ ਘੱਟ ਪਾਣੀ ਨਿਕਲ ਜਾਵੇ ਫਿਰ ਉਹਨੂੰ ਤੇਜ਼ ਗੈਸ ਦੇ ਵਿੱਚ ਪਕਾਉ ਮਤਲਬ ਇੱਦਾਂ ਕਰਕੇ ਅਸੀਂ ਕੋਈ ਨਾ ਕੋਈ ਹਰ ਹਰ ਕਿਸੀ ਕੋਲ ਅਲੱਗ ਇੱਕ ਤਰੀਕਾ ਹੁੰਦਾ ਕੋਈ ਵੀ ਪਕਵਾਨ ਬਣਾਉਣ ਦਾ ਤਾਂ ਉਹ ਆਪਣੇ ਨਜ਼ਰੀਏ ਦੇ ਨਾਲ ਪੁੱਛਦਾ ਕਿ ਉਹ ਇੱਦਾਂ ਬਣਿਆ ਤਾਂ ਅਸੀਂ ਵੀ ਉੱਦਾਂ ਬਣਾਉਣ ਦੀ ਕੋਸ਼ਿਸ਼ ਕਰੀਏ